ਹਾਂ ਮੇਰੇ ਕੋਲ ਪੰਛੀਆਂ ਨੂੰ ਆਕਰਸ਼ਿਤ ਕਰਨ ਲਈ ਕੁਝ ਸੁਝਾਅ ਹਨ ਜਿਵੇਂ ਕਿ ਆਪਣੇ ਘਰ ਜਾਂ ਬਾਗ ਵਿੱਚ ਪੰਛੀਆਂ ਨੂੰ ਅਨਾਜ ਲਈ ਬਰਤਨ ਹੋਣੇ ਚਾਹੀਦੇ ਹਨ ਅਤੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਪੰਛੀਆਂ ਨੂੰ ਫੁੱਲ ਬਹੁਤ ਪਸੰਦ ਹੁੰਦੇ ਨੇ ਪੰਛੀਆਂ ਲਈ ਉਹ ਵਿਹੜੇ ਵਿ ਫੁੱਲ ਲਗਾਉਣੇ ਚਾਹੀਦੇ ਨੇ ਔਰ ਪੰਛੀਆਂ ਦੇ ਬੈਠ ਬੈਠਣ ਲਈ ਜਗ੍ਹਾ ਹੋਣੀ ਚਾਹੀਦੀ ਆ ਜਿਵੇਂ ਕਿ ਬਾਗ ਵਿੱਚ ਐਸੋ ਇਹੋ ਜਿਹੇ ਦਰੱਖਤ ਲਗਾਉਣੇ ਚਾਹੀਦੇ ਹਨ ਜਿੰਨ੍ਹਾਂ ਵਿੱਚ ਉਹ ਬੈਠ ਸਕਣ ਅ ਰਾਤ ਨੂੰ ਆ ਕੇ ਸੋ ਸਕਣ ਅਤੇ ਇਹੋ ਜਿਹੇ ਪੌਦੇ ਲਗਾਓ ਔਰ ਆਪਣੇ ਵਿਹੜੇ ਵਿੱਚ ਮੈਂ ਬਹੁਤ ਸਾਰਾ ਅਨਾਜ ਉਹਨਾਂ ਨੂੰ ਦਿੰਦੀ ਹਾਂ ਮੈਂ ਆਪਣੇ ਵਿਹੜੇ ਵਿੱਚ ਫੁੱਲ ਲਗਾਏ ਹੋਏ ਨੇ ਔਰ ਮੈਂ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਅਤੇ ਉਹਨਾਂ ਨੂੰ